ਸਥਾਨਕ ਕਲਾਕਾਰਾਂ ਦੀ ਜੇ ਗੱਲ ਕਰੀਏ ਤਾਂ ਜੋ ਲੋਕ ਨਾਟਕ ਜਿਹੜੇ ਆ ਉਹ ਖੇਡਦੇ ਆ ਚਾਹੇ ਉਹ ਨੁੱਕੜ ਨਾਟਕ ਹੋਣ ਚਾਹੇ ਉਹ ਵੱਡੇ ਲੈਵਲ 'ਤੇ ਹੋਣ ਉਹ ਸਾਡੇ ਸਥਾਨ ਰਾਜ ਅਤੇ ਦੀ ਕਲਾ ਅਤੇ ਸੱਭਿਆਚਾਰ ਨੂੰ ਸਮੁੱਚੇ ਤੌਰ 'ਤੇ ਬਹੁਤ ਹੀ ਜ਼ਿਆਦਾ ਵੱਡੇ ਤਰੀਕੇ ਦੇ ਨਾਲ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਜਦੋਂ ਵੀ ਉਹ ਨਾਟਕ ਖੇਡਦੇ ਆ ਤਾਂ ਉਹ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਜਾ ਕੇ ਅਲੱਗ ਅਲੱਗ ਜਗ੍ਹਾ 'ਤੇ ਜਾ ਕੇ ਜਿਹੜਾ ਨਾਟਕ ਕਰਦੇ ਆ ਅਤੇ ਆਪਣੀ ਵਿਰਾਸਤ ਨੂੰ ਦਿਖਾਉਂਦੇ ਆ ਅਤੇ ਨਾਟਕ ਦੇ ਵਿੱਚ ਉਹ ਜੋ ਵੀ ਚੀਜ਼ਾਂ ਜਿਹੜੀਆਂ ਆ ਉਹ ਵਰਤਦੇ ਆ ਉਹ ਸਾਰੀਆਂ ਦੀਆਂ ਸਾਰੀਆਂ ਸਾਡੀ ਵਿਰਾਸਤ ਨੂੰ ਦਿਖਾਉਣ ਦੇ ਵਿੱਚ ਮਦਦ ਕਰਦੀਆਂ ਆ ਅਤੇ ਜਦੋਂ ਅਸੀਂ ਲੋਕਾਂ ਨੂੰ ਆਪਣੇ ਨਾਟਕ ਦਿਖਾਉਂਦੇ ਹਾਂ ਤਾਂ ਇਹਨਾਂ ਚੀਜ਼ਾਂ ਦੇ ਨਾਲ ਅਸੀਂ ਲੋਕਾਂ ਨੂੰ ਅਲ ਜਾਣਕਾਰੀ ਦੇ ਸਕਦੇ ਹਾਂ ਕਿ ਸਾਡਾ ਸਾਡੀ ਵਿਰਾਸਤ ਕੀ ਰਹੀ ਹੈ ਅਤੇ ਕਿਵੇਂ ਅਸੀਂ ਆਪਣੀ ਵਿਰਾਸਤ ਨੂੰ ਜਿਉਂਦਾ ਰੱਖਦੇ ਹਾਂ